ਇੱਕ ਜੀਰੋ ਇੱਕ ਚਾਰ ਇੱਕ ਛੇ ਦੋ ਜੀਰੋ ਸੱਤ ਪੰਜ ਛੇ ਸੱਤ ਇੱਕ ਚਾਰ ਪੰਜ ਜੀਰੋ ਸੱਤ ਛੇ ਪੰਜ ਛੇ ਜੀਰੋ ਸੱਤ ਅੱਠ ਛੇ ਸੱਤ ਛੇ ਸੱਤ ਅੱਠ ਛੇ ਸੱਤ